ਮੈਂ ਲਿਖਣੇ ਨਾਲੋਂ ਜ਼ਿਆਦਾ ਅੱਜ ਕੱਲ੍ਹ ਮੋਬਾਇਲ 'ਤੇ ਟਾਈਪ ਕਰਨਾ ਜ਼ਿਆਦਾ ਪਸੰਦ ਕਰਦਾ ਹਾਂ ਕਿਉਂਕਿ ਮੈਂ ਟਾਈਪ ਕਰਕੇ ਇਹਨੂੰ ਕਿਤੇ ਵੀ ਲੈ ਕੇ ਜਾ ਸਕਦਾ ਹਾਂ ਨਹੀਂ ਮੈਨੂੰ ਪਹਿਲਾਂ ਆਪਣੀਆਂ ਬੁੱਕਸ ਅਤੇ ਕਲਮ ਨਾਲ਼ ਰੱਖਣੀ ਪੈਂਦੀ ਸੀ